ਮੈਂ ਪ੍ਰੇਮ ਸਿੰਘ ਮਿਰਜਾਪੁਰ ਨਿਵਾਸੀ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਅੱਜ ਸ਼ਹਿਰ ਅਤੇ ਪਿੰਡਾਂ ਦੇ ਸਕੂਲਾਂ ਵਿੱਚ ਪਹੜਾ ਬੜਾ ਅੰਤਰ ਹੈ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸ਼ਹਿਰ ਦੇ ਸਕੂਲਾਂ ਵਿੱਚ ਪਿੰਡਾਂ ਦੇ ਸਕੂਲ ਨਾਲੋਂ ਕਈ ਗੱਲਾਂ ਦਾ ਫਰਕ ਹੁੰਦਾ ਹੈ ਸ਼ਹਿਰ ਸ਼ਹਿਰ ਵਾਲੇ ਮੋਟਰਸਾਈਕਲ 'ਤੇ ਜਾਂ ਬੱਸਾਂ 'ਤੇ ਆਦਿ 'ਤੇ ਜਾਂਦੇ ਹਨ ਪਿੰਡਾਂ ਵਿੱਚ ਸਕੂਲਾਂ ਵਿੱਚ ਆਦਮੀ ਨੂੰ ਪੈਦੇ ਬੱਚਿਆਂ ਨੂੰ ਪੈਦਲ ਹੀ ਜਾਣਾ ਪੈਂਦਾ ਹੈ ਜੇ ਉਹ ਕਿਤੇ ਦੂਰ ਜਾਣਾ ਜਾਂਦੇ ਹਨ ਤਾਂ ਉਹਨਾਂ ਦੇ ਜੇਬ ਦੇ ਵਿੱਚ ਕੋਈ ਪੈਸਾ ਵੀ ਨਹੀਂ ਹੁੰਦਾ ਸ਼ਹਿਰ ਵਾਲੇ ਬੱਚਿਆਂ ਕੋਲ ਜੇਬ ਦੇ ਵਿੱਚ ਪੈਸੇ ਵੀ ਹੁੰਦੇ ਹਨ ਅਤੇ ਮੋੜ ਮੋੜ 'ਤੇ ਉਹਨਾਂ ਨੂੰ ਦੁਕਾਨਾਂ ਵੀ ਮਿਲ ਜਾਂਦੀਆਂ ਹਨ ਪਿੰਡ ਵਾਲੇ ਬੱਚੇ ਨੂੰ ਅਗਰ ਸ਼ਹਿਰ ਬਾਹਰ ਦੂਰ ਕਿਤੇ ਪੜ੍ਹਨਾ ਪੈ ਜੇ ਤਾਂ ਉਹਨਾਂ ਕੋਲ ਕੋਈ ਪੈਸਾ ਵੀ ਨਹੀਂ ਹੁੰਦਾ ਅਤੇ ਨਾ ਹੀ ਕੋਈ ਨੇੜੇ ਤੇੜੇ ਕੋਈ ਦੁਕਾਨ ਮਿਲਦੀ ਹੈ ਜਦੋਂ ਉਹ ਪਿੰਡ ਵਾਲੇ ਸ਼ਹਿਰ ਨੂੰ ਜਾਂਦੇ ਹਨ ਤਾਂ ਉਹਨਾਂ ਦੀ ਕਈਆਂ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਸ਼ਹਿਰ ਵਾਲੇ ਜਦੋਂ ਆਪਣੇ ਸਕੂਲ ਪੜ੍ਹਦੇ ਹਨ ਤਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਪਿੰਡ ਵਾਲਿਆਂ ਨੂੰ ਜਦੋਂ ਉਹ ਪੜ੍ਹਦੇ ਹਨ ਤਾਂ ਉਹਨਾਂ ਦੇ ਮਾਂ ਪਿਓ ਅਤੇ ਟੀਚਰਾਂ ਨੂੰ ਵੀ ਸਾਰਾ ਪਤਾ ਹੁੰਦਾ ਹੈ ਵੀ ਸਾਡਾ ਬੱਚਾ ਕਿਹੋ ਜਿਹਾ ਹੈ ਤਾਂ ਉਹ ਆਪਣੇ ਬੱਚਿਆਂ ਦਾ ਪਿੰਡਾਂ ਵਿੱਚ ਪੂਰਾ ਧਿਆਨ ਰੱਖਦੇ ਹਨ ਨਾਲੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਰਹਿੰਦੇ ਹਨ ਸ਼ਹਿਰ ਵਾਲੇ ਬੱਚੇ ਆਪਣੇ ਮਾਂ ਪਿਓ ਤੋਂ ਓਹਲੇ ਰਹਿੰਦੇ ਹਨ ਅਤੇ ਉਹ ਬਾਹਰ ਜਾ ਕੇ ਕੀ ਕਰਦੇ ਹਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਵਿੱਚ ਬੜਾ ਅੰਤਰ ਹੈ ਜੋ ਕਿ ਸਕੂਲਾਂ ਵਿੱਚ ਜਾਂਦਿਆਂ ਹੀ ਥਾਂ ਥਾਂ 'ਤੇ ਦੁਕਾਨਾਂ ਵੀ ਹੁੰਦੀਆਂ ਹਨ ਸ਼ਹਿਰ ਵਾਲੇ ਆਪਣੀ ਜੇਬ ਦੇ ਮੁਤਾਬਕ ਹੀ ਪੈਸੇ ਖਰਚ ਕਰ ਲੈਂਦੇ ਹਨ ਜਦਕਿ ਪਿੰਡਾਂ ਵਾਲਿਆਂ ਕੋਲ ਜ਼ਿਆਦਾ ਪੈਸੇ ਨਾ ਹੋਣ ਕਾਰਨ ਉਹ ਆਪਣੇ ਆਪਣਾ ਜੇਬ ਖਰਚ ਹੀ ਲੈ ਕੇ ਜਾਂਦੇ ਹਨ ਇਸ ਕਾਰਨ ਪਿੰਡ ਅਤੇ ਸ਼ਹਿਰ ਵੱਲ ਤਾਂ ਵਿੱਚ ਬੜਾ ਅੰਤਰ ਹੈ